ਚਿੱਤਰ ਕਰਦੇ ਸਮੇਂ ਮੈਂ ਕਈ ਤਰ੍ਹਾਂ ਦੇ ਸਪਲਾਈ ਦੀ ਵਰਤੋਂ ਕਰਦੀ ਹਾਂ ਜਿਵੇਂ ਕਿ ਬਰਸ਼ਿਸ਼ ਅਤੇ ਪੈਨਸਿਲਸ ਮੈਂ ਕਈ ਤਰ੍ਹਾਂ ਦੇ ਬਰਸ਼ਿਸ਼ ਦਾ ਵਰਤੋਂ ਕਰਦੀ ਹਾਂ ਜਿਵੇਂ ਕਿ ਫੈਨ ਬ੍ਰਸ਼ਿਸ਼ ਫਲੈਟ ਬਰਸ਼ਿਸ ਫਿਲਬਰਟ ਬਰਸ਼ਿਸ ਲਾਈਨਰ ਬਰਸ਼ਇਸ਼ ਆਕਰਲਿਕ ਬਰਸ਼ਿਸ਼ ਅਤੇ ਬਰਾਈਟ ਬਰਸਿਸ਼ ਅਤੇ ਪੈਨਸਿਲਾਂ ਦੀ ਵੀ ਵਰਤੋਂ ਕਰਦੀ ਹਾਂ ਜਿਵੇਂ ਕਿ ਗ੍ਰੇਫਾਈਟ ਪੈਨਸਿਲਸ ਕਲਰ ਪੈਨਸਿਲ ਗਰੀਸ ਪੈਨਸਿਲ ਵਾਟਰ ਕਲਰ ਪੈਨਸਿਲ ਅਤੇ ਕਾਰਬਨ ਪੈਨਸਿਲ ਮੈਨੂੰ ਚਿੱਤਰਕਾਰੀ ਕਰਨਾ ਇੰਨੀ ਕੁ ਜ਼ਿਆਦਾ ਪਸੰਦ ਹੈ ਕਿ ਮੈਂ ਆਪਣੇ ਵਿਹਲੇ ਟਾਈਮ ਵਿੱਚ ਉਹੀ ਸਭ ਕਰਦੀ ਰਹਿੰਦੀ ਹਾਂ ਅਤੇ ਮੈਂ ਆਪਣੇ ਕਮਰੇ ਨੂੰ ਆਪਣੇ ਚਿੱਤਰਕਾਰੀ ਨਾਲ ਹੀ ਸਜਾਇਆ ਹੋਇਆ ਹੈ ਮੈਂ ਚਿੱਤਰਕਾਰੀ ਬਚਪਨ ਤੋਂ ਕਰਦੀ ਆ ਰਹੀ ਹਾਂ ਅਤੇ ਆਪਣੇ ਕਾਲਜ ਵਿੱਚ ਵੀ ਕਰਦੀ ਹਾਂ ਅਤੇ ਮੈਨੂੰ ਇਸੇ ਕਰਕੇ ਕਈ ਸਾਰੇ ਇਨਾਮ ਵੀ ਮਿਲੇ ਹੋਏ ਨੇ ਮੇਰੇ ਘਰ ਦੇ ਮੈਨੂੰ ਚਿੱਤਰਕਾਰੀ ਦੇ ਨਾਲ ਹੀ ਕਈ ਸਾਰੇ ਕੰਮਾਂ ਨੂੰ ਕਹਿੰਦੇ ਨੇ ਕਿ ਇਹ ਕਰਕੇ ਤੂੰ ਆਪਣੇ ਫਿਊਚਰ ਨੂੰ ਬਣਾ ਸਕਦੀ ਹੈ ਅਤੇ ਮੈਂ ਚਿੱਤਰਕਾਰੀ ਕਰਦੇ ਸਮੇਂ ਇਹਨਾਂ ਦੇ ਕਈ ਬ੍ਰਾਂਡਸ ਨੂੰ ਯੂਜ ਵੀ ਕਰਦੀ ਹਾਂ ਜਿਵੇਂ ਕਿ ਜਿਵੇਂ ਕਿ ਫਾਬਰ ਕੈਸਲ ਕਾਰਨ ਕੈਰਨ ਕੈਰਨ ਕਲਰਸ ਡੋਮਸ ਦੇ ਕਲਰਸ ਅਤੇ ਅਕੈਲਮਿਨ ਕਲਰ ਕੈਮਲ ਕਲਰ ਪਰੀਜਮਾਕਲਰ ਅਤੇ ਆਰਤੀਜਾ ਕਲਰਸ ਇਹ ਸਭ ਮੈਨੂੰ ਮੇਰੀ ਚਿੱਤਰਕਾਰੀ ਵਿੱਚ ਬਹੁਤ ਹੀ ਜ਼ਿਆਦਾ ਰੋਲ ਪਲੇ ਕਰਦੇ ਨੇ ਜਿਵੇਂ ਕਿ ਇਹ ਇਹਨਾਂ ਦੇ ਬ੍ਰਾਂਡ ਹੀ ਮੈਨੂੰ ਮੇਰੀ ਡਰਾਇੰਗ ਨੂੰ ਵਧੀਆ ਕਰਵਾਉਂਦੇ ਨੇ ਅਤੇ ਅਤੇ ਮੈਂ ਇਹ ਸਭ ਆਪਣੇ ਕੋਲ ਦੀ ਦੁਕਾਨੋ ਹੀ ਖਰੀਦ ਲੈਂਦੀ ਹਾਂ ਜਿਹੜੇ ਮੈਨੂੰ ਅੰਕਲ ਸਸਤੇ ਵਿੱਚ ਦੇ ਜਾਂਦੇ ਨੇ ਕਿਉਂਕਿ ਮੈਂ ਉਹਨਾਂ ਤੋਂ ਹਰ ਹਰ ਹਫਤੇ ਬਾਅਦ ਇਹੀ ਸਭ ਖਰੀਦਣ ਜਾਨੀ ਹਾਂ ਜੋ ਕਿ ਮੈਨੂੰ ਇਹਨਾਂ ਦਾ ਰੇਟ ਸਸਤੇ ਵਿੱਚ ਲਗਾ ਜਾਂਦੇ ਨੇ ਕਦੇ ਕਦੇ ਕਈ ਚੀਜ਼ਾਂ ਮੈਨੂੰ ਮਹਿੰਗੇ ਵੀ ਲੱਗਦੀਆਂ ਨੇ ਪਰੰਤੂ ਅਗਰ ਆਪਾਂ ਇਹਨਾਂ ਨੂੰ ਦੇਖੀਏ ਤਾਂ ਇਹ ਜ਼ਿਆਦਾ ਮਹਿੰਗੀਆਂ ਨਹੀਂ ਨੇ ਅਗਰ ਆਪਾਂ ਬ੍ਰਾਂਡ ਦੇ ਹਿਸਾਬ ਨਾਲ ਕਲਰ ਨੂੰ ਲੈਦੇ ਹਾਂ ਅਤੇ ਉਹਨਾਂ ਦਾ ਪ੍ਰਾਈਜ਼ ਵੀ ਵੱਧ ਹੋ ਸਕਦਾ ਹੈ ਜੇ ਆਪਾਂ ਆਮ ਕਲਰ ਯੂਜ ਕਰੀਏ ਤਾਂ ਉਹਨਾਂ ਦਾ ਪ੍ਰਾਈਜ ਘੱਟ ਹੀ ਹੁੰਦਾ ਹੈ ਜੋ ਕਿ ਸਹੀ ਹੈ